ਹੈਲੋ ਭਾਅ ਜੀ ਤੁਸੀਂ ਸਵੀਗੀ ਤੋਂ ਗੱਲ ਕਰ ਰਹੇ ਹੋ ਮੈਂ ਨਾ ਇੱਕ ਘੰਟੇ ਪਹਿਲਾਂ ਆਪਣਾ ਆਡਰ ਕੀਤਾ ਸੀਗਾ ਜਿਸ ਵਿੱਚ ਇੱਕ ਦਾਲ ਮੱਖਣੀ ਇੱਕ ਬਟਰ ਨਾਨ ਅਤੇ ਇੱਕ ਪਨੀਰ ਮੰਗਵਾਇਆ ਸੀ ਉਦੋਂ ਮੈਂ ਅਤੇ ਉਹ ਨਾ ਉੱਥੋਂ ਸ਼ੋ ਹੋ ਰਿਹਾ ਸੀਗਾ ਕਿ ਫੋਟੀ ਫਾਈਵ ਮਿੰਨਟਸ ਤੱਕ ਮੇਰੇ ਘਰ ਪਹੁੰਚ ਜੂਗਾ ਪਰ ਹਜੇ ਤੱਕ ਕੋਈ ਵੀ ਮੈਨੂੰ ਅਪਡੇਟ ਨਹੀਂ ਆਇਆ ਮੇਰੇ ਤੱਕ ਹਜੇ ਤੱਕ ਪਹੁੰਚੀ ਨਹੀਂ ਆ ਪਹੁੰਚਿਆ ਨਹੀਂ ਆ ਮੇਰਾ ਆਰਡਰ ਅਤੇ ਮੇਰੇ ਘਰ ਗੈਸਟ ਆਉਣੇ ਸੀਗੇ ਹੁਣ ਉਹ ਚਲੇ ਵੀ ਗਏ ਆ ਹੁਣ ਆਰਡਰ ਕਦੋਂ ਤੋਂ ਖਾਣਾ ਕੋਈ ਉਹਦਾ ਮੈਨੂੰ ਪਤਾ ਨਹੀਂ ਕਿ ਕਦੋਂ ਆਊਗਾ ਕਿ ਕਦੋਂ ਨਹੀਂ ਆਉਗਾ ਕਿਰਪਾ ਕਰਕੇ ਹੁਣ ਮੈਂ ਆਰਡਰ ਕੈਂਸਲ ਕਰਨਾ ਚਾਹੁੰਦੀ ਹਾਂ ਅਤੇ ਮੈਂ ਉਹਦੀ ਪੇਮੈਂਟ ਔਨਲਾਈਨ ਕੀਤੀ ਸੀਗੀ ਅਤੇ ਕਿਰਪਾ ਕਰਕੇ ਤੁਸੀਂ ਮੈਨੂੰ ਉਹਦੀ ਸਾਰੀ ਰਿਫੰਡ ਦੇ ਦਿਓ ਅਤੇ ਮੈਨੂੰ ਦੱਸ ਦਿਓ ਕਿ ਕਦੋਂ ਤੱਕ ਤੁਸੀਂ ਰਿਫੰਡ ਮੈਨੂੰ ਮੇਰੇ ਅਕਾਊਂਟ ਤੱਕ ਆ ਜੂਗਾ ਧੰਨਵਾਦ